ਮੈਂ ਬਹੁਤ ਜ਼ਿਆਦਾ ਹੀ ਜਿਹੜੀਆਂ ਕਿ ਨਾ ਆਪਣੇ ਕਾਟ ਵਿੱਚ ਜਿਹੜੀਆਂ ਕਿ ਮੈਂ ਐਟਮ ਨੂੰ ਸਲੈਕਟ ਕੀਤਾ ਹੈਗਾ ਵਾ ਕਿ ਜਿਹੜੀਆਂ ਮੈਨੂੰ ਬਸ ਇਹ ਹੁੰਦਾ ਕਿ ਮੈਂ ਖਰੀਦਣੀਆਂ ਹੈਗੀਆਂ ਵਾਂ ਬਸ ਸਲੈਕਟ ਕਰੀ ਜਾ ਰਹੀ ਹਾਂ ਕਰੀ ਜਾ ਰਹੀ ਹਾਂ ਕਰੀ ਜਾ ਰਹੀ ਹਾਂ ਓ ਬਸ ਸਾਰੀਆਂ ਹੀ ਮੇਰੀਆਂ ਹੁਣ ਕਾਟ ਵਿੱਚ ਪਈਆਂ ਵਾ ਅਤੇ ਜਿਹੜੀ ਮਿਨਜ਼ ਮੇਰੇ ਕੋਲ ਅਰਨਿੰਗ ਹੈਗੀ ਆ ਉਹ ਮੇਰੀ ਘੱਟ ਹੈਗੀ ਆ ਕਿ ਮੈਂ ਜਿਹੜੀਆਂ ਸਾਰੀਆਂ ਚੀਜ਼ਾਂ ਮੈਂ ਜਿਹੜੀਆਂ ਬਾਏ ਜਿਹੜੀਆਂ ਹੈਗੀਆਂ ਖਰੀਦ ਨਹੀਂ ਸਕਦੀ ਹੈਗੀ ਹੁਣ ਮੈ ਸੋਚ ਰਹੀ ਹੈਗੀ ਹਾਂ ਕਿ ਮੈਂ ਨਾ ਸਾਰੀਆਂ ਜਿਹੜੀਆਂ ਚੀਜਾਂ ਨੂੰ ਜਿਹੜੇ ਮੈਂ ਸਾਰੀਆਂ ਓਨਲਾਈਨ ਸ਼ੌਪਿੰਗ ਕਰਨ ਵਾਸਤੇ ਮੈਂ ਕਾਰਟ ਵਿੱਚ ਜਿਹੜੀਆਂ ਮੈਂ ਆਪਣੀਆਂ ਆਈਟਮ ਨਾ ਜਿਹੜੀਆਂ ਸ਼ਾਮਿਲ ਕੀਤਾ ਸਲੈਕੇਟ ਕੀਤਾ ਹੈਗਾ ਵਾ ਉਹ ਮੈਂ ਇਹ ਸੋਚਦੀ ਪਈ ਹੈਗੀ ਹਾਂ ਕਿ ਮੈਂ ਇੱਕ ਇੱਕ ਕਰਕੇ ਹਟਾਵਾਂ ਕਿਉਂਕਿ ਕਿਉਂਕਿ ਸਾਰੀਆਂ ਤਾਂ ਮੈਂ ਖ਼ਰੀਦਣੀਆਂ ਨਹੀਂ ਹੈਗੀਆਂ ਇੱਕ ਇੱਕ ਕਰਕੇ ਮੈਂ ਜਿਹੜੀਆਂ ਆਪਣੀਆਂ ਹਟਾਉਣੀਆਂ ਹੈਗੀਆਂ ਚੀਜ਼ਾਂ ਜਿਹੜੀਆਂ ਮੈ ਖਰੀਦੂੰਗੀ ਉਹ ਮੈਂ ਰੱਖ ਲੂੰਗੀ ਪਰ ਜਿਹੜੀਆਂ ਮੈਨੂੰ ਨਹੀਂ ਚਾਹੀਦੀਆਂ ਹੈਗੀਆਂ ਅਤੇ ਉਹਨਾਂ ਨੂੰ ਮੈਂ ਜਿਹੜਾ ਖਰੀਦਣਾ ਮੈਂ ਨਹੀਂ ਚਾਹੁੰਦੀ ਹੈਗੀ ਅਤੇ ਉਹਨਾਂ ਨੂੰ ਮੈਂ ਜਿਹੜੀਆਂ ਆਈਟਮ ਜਿਹੜੀਆਂ ਹੈਗੀਆਂ ਮੈਂ ਸਲੈਕਟ ਕਰਕੇ ਅਤੇ ਉਹਨਾਂ ਨੂੰ ਮੈਂ ਆਪਣੇ ਕਾਰਟ ਤੋਂ ਹਟਾਉਂਦੀ ਹਾਂ ਕਿਉਂਕਿ ਬਹੁਤ ਜ਼ਿਆਦੀਆਂ ਹੀ ਮੈਂ ਆਪਣੀਆਂ ਸਲੈਕਟ ਕੀਤੀਆਂ ਹੈਗੀਆਂ ਵਾ ਮੈਂ ਮੀਸ਼ੋ 'ਤੇ ਗਈ ਉੱਥੇ ਜਾ ਕੇ ਸਾਰੀਆਂ ਸਲੈਕਟ ਕਰ ਲਈਆਂ ਨੇਲ ਪੇਂਟਸ ਦੇਖੇ ਪਰਫਿਊਮ ਜੇ ਦੇਖ ਲਏ ਕੋਈ ਮੈਂ ਆਪਣੀ ਡਰੈਸਸ ਦੇਖ ਲਈਆਂ ਜੈਕਟਿਸ ਦੇਖ ਲਈਆਂ ਜੀਨਸ ਦੇਖ ਲੀਆਂ ਜਦ ਮੈਂ ਆਪਣਾ ਕੋਈ ਵੀ ਜਿਵੇਂ ਘਰ ਦਾ ਸਮਾਨ ਦੇਖ ਲਿਆ ਕਿਚਨ ਦਾ ਸਮਾਨ ਦੇਖ ਲਿਆ ਬੋਟਲਸ ਹੇਅਰ ਅਸੈਸਰੀ ਜਿਵੇਂ ਦੇਖ ਲਈ ਜਾਂ ਮੈਂ ਕਹਿ ਸਕਦੀ ਕਿ ਬਾਥਰੂਮ ਦੇ ਜਿਵੇਂ ਚੀਜ਼ਾਂ ਜਿਵੇਂ ਸੋਪ ਕਲੈਂਜ਼ਿੰਗ ਦੀਆਂ ਚੀਜ਼ਾਂ ਫੇਸ਼ੀਅਲ ਕਰੀਮਸ ਦੇਖ ਲਈਆਂ ਟਬਸ ਦੇਖ ਲਏ ਟੋਵਲਸ ਦੇਖ ਲਏ ਅਤੇ ਬਲੈਂਕਿਟਸ ਦੇਖ ਲਈਆਂ ਹਰ ਇੱਕ ਚੀਜ਼ ਜਿਹੜੀ ਮਿਨਜ਼ ਨੀਡੀ ਹੁੰਦੀ ਆ ਮੈਂ ਹਰ ਇੱਕ ਚੀਜ਼ ਜਿਹੜੀ ਹੈਗੀ ਉਹ ਮੈਂ ਸਲੈਕਟ ਕਰੀ ਜਾ ਰਹੀ ਹੈਗੀ ਹਾਂ ਦੈਨ ਮੈਂ ਆਪਣੇ ਕਾਰਟ ਵਿੱਚ ਰੱਖੀ ਜਾ ਰਹੀ ਹੈਗੀ ਹਾਂ ਅਤੇ ਉਹ ਸਾਰੀਆਂ ਹੀ ਚੀਜ਼ਾਂ ਕਾਰਟ ਵਿੱਚ ਪਈਆਂ ਵਾ ਮਿਨਜ਼ ਕੋਈ ਵੀ ਅਜਿਹੀ ਚੀਜ਼ ਨਹੀਂ ਹੋਵੇਗੀ ਜਾਂ ਮਿਨਜ਼ ਖਰੀਦੀ ਹੋਵੇਗੀ ਜਾਂ ਬਾਏ ਕਰ ਲਈ ਹੋਵੇਗੀ ਖਰੀਦ ਲਈ ਹੋਵੇਗੀ ਹੁਣ ਮੈਂ ਸੋਚ ਰਹੀ ਕਿ ਕਰ ਲਾਂ ਕਿਉਂਕਿ ਜਿਵੇਂ ਲੈਦਰ ਵਗੈਰਾ ਹੋਏ ਜਾਂ ਤਾਂ ਕਹਿ ਸਕਦੇ ਹਾਂ ਪੈਨ ਪਤੀਲੇ ਹੋ ਗਏ ਚਾਹ ਦੇ ਪਤੀਲੇ ਹੋ ਗਏ ਜਾਂ ਬੋਕਸਿਸ ਵਗੈਰਾ ਹੋ ਗਏ ਟੈਡੀ ਬੀਅਰਸ ਹੋ ਗਏ ਵੋਚਿਸ ਹੋ ਗਈਆਂ ਐਲਡੀ ਲਾਈਟਸ ਫੈਨਸ ਚਾਰਜਰ ਮੋਬਾਇਲ ਕਵਰਸ ਫਰੇਮਸ ਛੋਟੀਆਂ ਛੋਟੀਆਂ ਚੀਜ਼ਾਂ ਕਹਿ ਸਕਦੇ ਹੈਗੇ ਆਪਾਂ ਜਿਵੇਂ ਨੇਲਸ ਕਹਿ ਸਕਦੇ ਹਾਂ ਰਿੰਗਸ ਚੇਂਨਜ਼ ਹਰ ਇੱਕ ਚੀਜ਼ ਸਲੈਕਟ ਕੀਤੀ ਪਈ ਹੈਗੀ ਆ ਪਰ ਬਾਏ ਮੈਂ ਕੋਈ ਵੀ ਨਹੀਂ ਕੀਤੀ ਹੁਣ ਮੈਂ ਇੱਕ ਇੱਕ ਕਰਕੇ ਜਿਹੜੀਆਂ ਚੀਜ਼ਾਂ ਮੈਂ ਸੋਚ ਰਹੀ ਹਾਂ ਕਿ ਹਾਂ ਇਹ ਚੀਜ਼ਾਂ ਮੈਂ ਹਾਲੇ ਬਾਏ ਕਰਨੀਆਂ ਉਹ ਮੈਂ ਰੱਖ ਲੂੰਗੀ ਪਰ ਜਿਹੜੀਆਂ ਚੀਜ਼ਾਂ ਜਿਹੜੀਆਂ ਗੀਆਂ ਵਾ ਮੈਂ ਓਨਲਾਈਨ ਸ਼ੋਪਿੰਗ ਕਰਨ ਵਾਸਤੇ ਮੈਂ ਹੁਣ ਨਹੀਂ ਰੱਖਣੀਆਂ ਅਤੇ ਉਹ ਜਿਹੜੀਆਂ ਹੈਗੀਆਂ ਕੀ ਆ ਆਪਣੀ ਕਾਰਟ ਤੋਂ ਕਿ ਮੈਂ ਆਪਣੀ ਆਈਟਮ ਜਿਹੜੀਆਂ ਹਟਾ ਦਊਂਗੀ ਅਤੇ ਹੁਣ ਸੋਚ ਰਹੀ ਕਿ ਕਿਹੜੀਆਂ ਕਿਹੜੀਆਂ ਆਈਟਮਸ ਰੱਖਾਂ ਅਤੇ ਕਿਹੜੀਆਂ ਕਿਹੜੀਆਂ ਆਈਟਮਸ ਜਿਹੜੀਆਂ ਵਾ ਉਹ ਨਾ ਰੱਖਾ ਅਤੇ ਇਹ ਮੈਂ ਬਹੁਤ ਜ਼ਿਆਦਾ ਸੋਚ ਰਹੀ ਹਾਂ ਕਿਹੜੀਆਂ ਆਈਟਮਸ ਰੱਖਾਂ ਹੁਣ ਮੈਂ ਹੁਣ ਮੈਂ ਜਿਹਨਾਂ ਨੂੰ ਖਰੀਦਣਾ ਨਹੀਂ ਚਾਹੁੰਦੀ ਜਿਵੇਂ ਮੈਂ ਰੈਬਰ ਵਗੈਰਾ ਉਹ ਮੈਂ ਨਹੀਂ ਖਰੀਦਣਾ ਚਾਹੁੰਦੀ ਕਿਉਂਕਿ ਮੰਮਾ ਮੇਰੇ ਪਹਿਲਾਂ ਹੀ ਰੈਬਰ ਲੈ ਆਏ ਆ ਵੋਚ ਵੋਚ ਵੀ ਮੈਂ ਖਰੀਦਣਾ ਨਹੀਂ ਚਾਹੁੰਦੀ ਇਹ ਚੀਜ਼ਾਂ ਜਾ ਕੇ ਕਿ ਮੈਂ ਆਪਣੇ ਕਾਰਟ ਤੋਂ ਹਟਾਉਣੀਆਂ ਹੈਗੀਆਂ ਵਾ ਬਲੈਂਕਿਟਸ ਹੋਗੀਆਂ ਕਿਉਂਕਿ ਬਲੈਂਕਿਟਸ ਜਿਹੜੀਆਂ ਹੈਗੀਆਂ ਵਾ ਉਹ ਵੀ ਮੈਂ ਆਪਣੇ ਇੱਥੋਂ ਨੀਅਰ ਅਬਾਊਟ ਮਾਰਕੀਟ ਤੋਂ ਕੀ ਹੈਗੀ ਆ ਬਾਏ ਕਰ ਲਈ ਖਰੀਦ ਲਈ ਹੈਗੀ ਆ ਕਲੋਥਸ ਵਗੈਰਾ ਇਹ ਵੀ ਜਿਹੜੀਆਂ ਚੀਜ਼ਾਂ ਕਿ ਹਟਾਉਣੀ ਹੈਗੀਆਂ ਵਾ ਕਿਉਂਕਿ ਹੁਣ ਪਹਿਲਾਂ ਜਿਹੜੇ ਮੈਂ ਕਲੋਥਸ ਸਲੈਕਟ ਕੀਤੇ ਸੀ ਉਹ ਸਾਰੇ ਮੇਰੇ ਸਮਰ ਦੇ ਸੀ ਅਤੇ ਹੁਣ ਵਿੰਟਰ ਆ ਰਿਹਾ ਵਾ ਅਤੇ ਮੈਂ ਹੁਣ ਵਿੰਟਰ ਦੇ ਹੀ ਲਉਂਗੀ ਸਮਰ ਦੇ ਮੈਂ ਲੈ ਕੇ ਕੀ ਕਰਨੇ ਇਸ ਕਰਕੇ ਮੈਂ ਸਮਰ ਦੇ ਜਿਹੜੇ ਸੀ ਜਿੰਨੇ ਵੀ ਸੀ ਉਹ ਸਾਰੇ ਐਡ ਟੂ ਕਾਰਟ ਤੋਂ ਕੀ ਮੈਂ ਆਪਣੇ ਹਟਾ ਲੈਣੇ ਹੈਗੇ ਆ ਥੋੜ੍ਹੀਆਂ ਬਹੁਤੀਆਂ ਚੀਜ਼ਾਂ ਰਖੂੰਗੀ ਜਿਹੜੀਆਂ ਕਿ ਜ਼ਰੂਰੀ ਹੋਵੇਗੀ ਅਤੇ ਜਿਹੜੀਆਂ ਮੈਂ ਐਵੇਂ ਰੱਖੀਆਂ ਗਈਆਂ ਚੀਜ਼ਾਂ ਟਾਵਲਸ ਵਗੈਰਾ ਰੱਖਿਆ ਗਿਆ ਇਹ ਸਾਰੀ ਕਿ ਮੈਂ ਇੱਥੋਂ ਨੀਅਰ ਅਬਾਉਟ ਆਪਣੀ ਮਾਰਕੀਟ 'ਚੋਂ ਹੀ ਲੈ ਲਉਂਗੀ ਬਾਏ ਕਰ ਲਊਂ ਖਰੀਦ ਲਉਂਗੀ ਅਤੇ ਮੈਂ ਓਨਲਾਈਨ ਨਹੀਂ ਲੈਣਾ ਕਿਉਂਕਿ ਕਈ ਵਾਰ ਆਪਾਂ ਨੂੰ ਕੱਪੜੇ ਦਾ ਪਤਾ ਨਹੀਂ ਹੁੰਦਾ ਕਿ ਓਨਲਾਈਨ ਜਿਹੜਾ ਕੱਪੜਾ ਆਉਂਦਾ ਹੈਗਾ ਵਾ ਉਹ ਉਹਦਾ ਮਟੀਰੀਅਲ ਕਿੱਦਾਂ ਦਾ ਹੁੰਦਾ ਵਾ ਜਿਵੇਂ ਮੈਂ ਇੱਕ ਸੂਟ ਆਪਣਾ ਪਹਿਲਾਂ ਵੀ ਸਲੈਕਟ ਕੀਤਾ ਸੀ ਮੀਸ਼ੋ ਤੋਂ ਹੀ ਪਰਪਲ ਵੈਲਵਟ ਦਾ ਸੀ ਅਤੇ ਜਦੋਂ ਘਰ ਆਇਆ ਤਾਂ ਇੰਨਾਂ ਜ਼ਿਆਦਾ ਹੀ ਪਤਲਾ ਸੀ ਕਿ ਉਹਦੇ ਆਰ ਪਾਰ ਆਰਾਮ ਨਾਲ ਦੇਖਿਆ ਜਾ ਸਕਦਾ ਸੀ ਅਤੇ ਮਟੀਰੀਅਲ ਨਹੀਂ ਸੀ ਵਧੀਆ ਹੈਗਾ ਉਸ ਕੱਪੜੇ ਦਾ ਅਤੇ ਹੁਣ ਮੈਂ ਸੋਚ ਰਹੀ ਹੈਗੀ ਕਿ ਮੈਂ ਕਲੋਥਸ ਵਗੈਰਾ ਜਿਹੜਾ ਆਪਣਾ ਮਾਰਕਿਟ ਤੋਂ ਹੀ ਲਿਆ ਕਰਾਂ ਕਿਉਂਕਿ ਉਹ ਇੱਕ ਚੀਜ਼ ਫੜੀ ਪਤਾ ਲੱਗਦੀ ਕਿ ਹਾਂ ਵੀ ਇਹਦਾ ਸਟੱਫ ਕਿਹੋ ਜਿਹਾ ਹੈਗਾ ਵਾ ਪਹਿਨੀ ਚੀਜ਼ ਸੋਹਣੀ ਲੱਗਦੀ ਹੈ ਕਿ ਨਹੀਂ ਲੱਗਦੀ ਹੈਗੀ ਅਤੇ ਇਸ ਕਰਕੇ ਮੈਂ ਸੋਚ ਰਹੀ ਕੱਪੜੇ ਵਗੈਰਾ ਨਾ ਲਿਆ ਕਰਾਂ ਕੱਪੜੇ ਵਗੈਰਾ ਕਿ ਮੈਂ ਨਿਅਰ ਅਬਾਊਟ ਮਾਰਕਿਟ 'ਚੋਂ ਲਿਆ ਕਰਾਂ ਨਾ ਹੀ ਮੈਂ ਓਨਲਾਈਨ ਸ਼ੋਪਿੰਗ ਵਗੈਰਾ ਨਾ ਹੀ ਕਰਿਆ ਕਰਾਂ ਕੱਪੜੇ ਦੀ ਬਲੈਂਕਿਟਸ ਵਗੈਰਾ ਕਈ ਵਾਰ ਹੁੰਦਾ ਕਿ ਬਲੈਂਕਿਟਸ ਵਧੀਆ ਨਿਕਲ ਆਉਂਦੇ ਆ ਬਟ ਜ਼ਿਆਦਾਤਰ ਬਲੈਂਕਿਟਸ ਵੀ ਕਿਉਂਕਿ ਬਲੈਂਕਿਟਸ ਜਦੋਂ ਬਾਏ ਕੀਤੀ ਸੀ ਇੱਕ ਵਾਰ ਉਹ ਵੀ ਉਹਦਾ ਸਟੱਫ ਵੀ ਨਹੀਂ ਸੀ ਵਧੀਆ ਆ ਰਿਹਾ ਇਸ ਕਰਕੇ ਮੈਂ ਐਡ ਟੂ ਕਾਰਟ ਤੋਂ ਉਹ ਵੀ ਜਿਹੜੀ ਚੀਜ਼ ਹੈਗੀ ਆ ਰਿਮੂਵ ਕਰ ਦੇਣੀ ਹੈਗੀ ਆ ਅਤੇ ਕਈ ਜਿਹੜੀਆਂ ਆਇਟਮ ਸ਼ਾਮਿਲ ਕੀਤੀਆਂ ਹੈਗੀਆਂ ਵਾ ਪਰ ਹੁਣ ਮੈਂ ਇਹੀ ਫੈਸਲਾ ਕਰਦੀ ਪਈ ਜਦੋਂ ਮੈਂ ਜਦੋਂ ਖਰੀਦਣਾ ਨਹੀਂ ਚਾਹੁੰਦੀ ਅਤੇ ਫਿਰ ਉਹਨਾਂ ਨੂੰ ਮੈਂ ਕਿਉਂ ਆਪਣੇ ਕਾਰਟ ਵਿੱਚ ਰੱਖਾਂ ਉਸ ਚੀਜ਼ਾਂ ਨੂੰ ਮੈ ਰਿਮੂਵ ਕਰ ਦਿਆ ਕਰਾਂ ਕਿਉਂ ਕਾਰਟ 'ਚ ਰੱਖਾਂ ਕਿਉਂਕਿ ਫਿਰ ਤਾਂ ਸ ਕਿੰਨਾਂ ਹੀ ਸਮਾਨ ਕਾਰਟ ਵਿੱਚ ਪਿਆ ਰਹਿੰਦਾ ਫਿਰ ਮੈਂ ਕਨਫਿਊਜ਼ ਹੋ ਜਾਂਦੀ ਹਾਂ ਕਿ ਮੈ ਲੈਣੀ ਕਿਹੜੀ ਚੀਜ਼ ਕਿਹੜੀ ਨਹੀਂ ਲੈਣੀ ਅਤੇ ਅੱਜ ਫਿਰ ਇਹੀ ਸੋਚਣਾ ਕਿ ਹਾਂ ਵੀ ਜਿਵੇਂ ਕੱਪੜੇ ਵਗੈਰਾ ਹੋ ਗਏ ਜਾਂ ਜਿਹੜੀ ਚੀਜ਼ ਮੈਂ ਖਰੀਦ ਚੁੱਕੀ ਹੈਗੀ ਹੁਣ ਮੈਨੂੰ ਉਸ ਚੀਜ਼ ਦੀ ਲੋੜ ਨਹੀਂ ਹੈਗੀ ਅਤੇ ਉਹ ਸਭ ਚੀਜ਼ਾਂ ਕਿ ਮੈਂ ਰਿਮੂਵ ਕਰ ਦਾਂ ਮੀਨਸ ਐਡ ਟੂ ਕਾਰਟ 'ਚ ਮੈਂ ਨਾ ਰੱਖਾਂ ਉਹ ਸਾਰੀ ਚੀਜ਼ਾਂ ਨੂੰ ਕੀ ਆ ਮੈਂ ਹਟਾ ਦਾਂ ਆਈਟਮਸ ਤੋਂ ਕਾਰਟ ਤੋਂ ਹਟਾ ਦਾਂ